ਲਿਖਣਾ ਰਾਈਟਿੰਗ ਕਰਨਾ ਸ਼ੌਕ ਹੈ ਮੇਰਾ ਅਤੇ ਇਹਦੇ ਰਿਟਨ ਲਿਖਣ ਵਾਸਤੇ ਸਾਨੂੰ ਆਪਣੇ ਆਲੇ ਦੁਆਲੇ ਨੂੰ ਦੇਖਣਾ ਪੈਂਦਾ ਬਈ ਆਲੇ ਦੁਆਲੇ ਕੀ ਹੋ ਰਿਹਾ ਕੀ ਘਟਨਾਵਾਂ ਹੋ ਰਹੀਆਂ ਕੀ ਝੂਠ ਹੋ ਰਿਹਾ ਕੀ ਸੱਚ ਹੋ ਰਿਹਾ ਉਹਦੇ ਬਾਰੇ ਸਾਨੂੰ ਆਪਣੀ ਕਲਮ ਨਾਲ ਉਹਦਾ ਲਿਖਣਾ ਪੈਂਦਾ ਵਿਚਾਰ ਆਪਣੇ ਲਿਖਣੇ ਪੈਂਦੇ ਆ ਅਤੇ ਅਸੀਂ ਇਹਦੇ ਨਾਲ ਆਪਣੇ ਸੱਭਿਆਚਾਰ ਨੂੰ ਅਮੀਰ ਇਸ ਸੱਚਾ ਸੁੱਚਾ ਲਿਖ ਕੇ ਅਮੀਰ ਕਰ ਸਕਦੇ ਹਾਂ ਅਸੀਂ ਆਪਣੇ ਵਿਰਸੇ ਨੂੰ ਇੱਕ ਕਲਮਬੱਧ ਕਰ ਸਕਦੇ ਹਾਂ ਵੀ ਅਸੀਂ ਆਪਣਾ ਵਿਰਸਾ ਕਿਵੇਂ ਦੇਖਿਆ ਅਤੇ ਉਹਨੂੰ ਕਲਮਬੱਧ ਕਰ ਸਕਦੇ ਹਾਂ ਜੋ ਸਾਡੇ ਵਿਰਸੇ ਵਿੱਚ ਹੁੰਦਾ ਸਾਡਾ ਅਮੀਰ ਵਿਰਸਾ ਅਸੀਂ ਉਹਦੇ 'ਚ ਸਾਡਾ ਖਾਣਾ ਕੈਸਾ ਹੋ ਸਕਦਾ ਸਾਡਾ

ਸਾਹਿਤ ਕੈਸਾ ਹੈ ਸਾਡਾ ਹਿਸਟੋਲ ਹਿਸਟਰੀ ਕੈਸੀ ਆ ਉਹਦੇ ਬਾਰੇ ਲਿਖ ਸਕਦੇ ਹਾਂ ਇੱਕ ਸਾਫ ਸੁਥਰੀ ਚੀਜ਼ ਨੂੰ ਲਿਖ ਸਕਦੇ ਹਾਂ ਅਸੀਂ ਆਪਣਾ ਵੀ ਸਾਡਾ ਜਿਹੜਾ ਅਮੀਰ ਵਿਰਸਾ ਉਹਨੂੰ ਅਸੀਂ ਕਿਵੇਂ ਦੇਖਿਆ ਕਿਵੇਂ ਪੜ੍ਹਿਆ ਉਹਨੂੰ ਅਸੀਂ ਇੱਕ ਲਿਖ ਸਕਦੇ ਹਾਂ ਇੱਕ ਵਧੀਆ ਤਰੀਕੇ ਨਾਲ ਅਤੇ ਜੋ ਸੱਚਾਈ ਮੋਸਟਲੀ ਅਸੀਂ ਸਾਫ ਸੁਥਰਾ ਲਿਖ ਕੇ ਆਪਣੇ ਜਿਹੜੀ ਆ ਰਾਈਟਿੰਗ ਨੂੰ ਇੱਕ ਅੱਛਾ ਬਣਾ ਸਕਦੇ ਹਾਂ ਇੱਕ ਸਾਫ ਸੁਥਰਾ ਲਿਖਣਾ ਇੱਕ ਸੱਚ ਲਿਖਣਾ ਜੋ ਸੱਚ ਲਿਖਿਆ ਸੱਚ ਦੇਖਿਆ ਤੁਸੀਂ ਉਹ ਸੱਚ ਹੀ ਲਿਖਣਾ ਕਿਸੇ ਦੇ ਪ੍ਰਭਾਵ ਹੇਠ ਆ ਕੇ ਗਲਤ ਨਹੀਂ ਲਿਖਣਾ ਤੁਸੀਂ ਉਹਨੂੰ ਸੱਚ ਲਿਖੋ ਜੋ ਆਪਣਾ ਆਲਾ ਦੁਆਲਾ ਦੇਖਦੇ ਹੋ ਉਹ ਉਹਨੂੰ ਇੱਕ ਕਲਮਬੱਧ ਕਰ ਸਕਦੇ ਹੋ ਇੱਕ ਵਧੀਆ ਤਰੀਕੇ ਨਾਲ ਸੱਚ ਲਿਖ ਸਕਦੇ ਹੋ ਉਹਦੇ ਕਰਕੇ ਅਸੀਂ ਆਪਣੇ ਕਲਮ ਨੂੰ ਸਾਫ ਸੁਥਰਾ ਬਣਾ ਸਕਦੇ ਹਾਂ ਅਤੇ ਕਲਮ ਆਪਣੀ ਨੂੰ ਇੱਕ ਅੱਛਾ ਲਿਖ ਕੇ ਆਪਣੀ ਕਲਮ ਨੂੰ ਵੀ ਅਮੀਰ ਬਣਾ ਸਕਦੇ ਹਾਂ